ਮੈਂ ਰੇਲ ਗੱਡੀ ਦਾ ਜਿਹੜਾ ਸਫ਼ਰ ਆ ਉਹ ਕਾਫੀ ਵਾਰ ਕੀਤਾ ਹੈ ਇਸ ਕਰਕੇ ਮੈਂ ਉਹਦੀਆਂ ਜਿਹੜੀਆਂ ਰੇਲ ਗੱਡੀ ਦੀਆਂ ਸੀਟਾਂ ਹੋ ਗਈਆਂ ਇੰਜਨ ਹੋ ਗਈਆਂ ਜੋ ਵੀ ਉਹਦਾ ਮਟੀਰੀਅਲ ਜਾਂ ਕੁਝ ਵੀ ਆ ਜੋ ਜੋ ਮੈਂ ਐਕਸਪੀਰੀਅੰਸ ਕਰਿਆ ਹੈ ਉਹ ਮੈਂ ਬੜੇ ਆਰਾਮ ਨਾਲ ਦੱਸ ਸਕਦੀ ਹਾਂ ਹੁਣ ਰੇਲ ਗੱਡੀ 'ਤੇ ਮੈਂ ਦੋ ਤਰ੍ਹਾਂ ਦਾ ਜਿਹੜਾ ਸਫ਼ਰ ਆ ਉਹ ਤੈਅ ਕੀਤਾ ਹੈ ਇੱਕ ਤਾਂ ਰਿਜਰਵਡ ਸੀਟਸ ਜਿਹੜੀਆਂ ਮਤਲਬ ਮੈਂ ਜਦੋਂ ਆਪਾਂ ਸੀਟਸ ਬੁੱਕ ਕਰਵਾਉਂਦੇ ਹਾਂ ਉਦੋਂ ਕਿੱਦਾਂ ਕਿੱਦਾਂ ਸਭ ਫੈਸਿਲਿਟੀ ਮਿਲਦੀ ਆ ਜਾਂ ਫਿਰ ਜਦੋਂ ਆਪਾਂ ਜਨਰਲੀ ਬੋਕਸ 'ਤੇ ਚੜ ਜਾਂਦੇ ਕੋਈ ਵੀ ਛੋਟੀ ਜਿਹੀ ਟਿਕਟ ਲੈ ਕੇ ਉਦੋਂ ਕਿੱਦਾਂ ਦੀ ਫੈਸਿਲਿਟੀਆਂ ਕਿੱਦਾਂ ਦਾ ਮਾਹੌਲ ਮਿਲਦਾ ਹੈ ਉਹ ਸਭ ਮੈਂ ਦੱਸ ਸਕਦੀ ਹਾਂ ਹੁਣ ਜਿੱਦਾਂ ਅਗਰ ਤਾ ਆਪਾਂ ਜਿਹੜੀਆਂ ਸੀਟਾਂ ਆ ਉਹ ਬੁੱਕ ਕਰਵਾਈਆਂ ਹੁੰਦੀਆਂ ਹੈ ਤਾਂ ਉਹ ਜਿਹੜੀਆਂ ਸੀਟਾਂ ਇਹ ਕਾਫੀ ਆਰਾਮਦਾਇਕ ਹੁੰਦੀਆਂ ਹੈ ਕੋਈ ਵੀ ਭੀੜ ਭਾੜ ਨਹੀਂ ਹੁੰਦੀ ਸਾਰੇ ਜਿਹੜੇ ਆ ਆਪੋ ਆਪਣੀਆਂ ਅਲੱਗ ਅਲੱਗ ਸੀਟਾਂ 'ਤੇ ਆਰਾਮ ਨਾਲ ਬੈਠੇ ਹੁੰਦੇ ਆ ਉਹਨਾਂ ਦੇ ਅੱਗੇ ਟੇਬਲ ਵੀ ਹੁੰਦਾ ਹੈ ਜਿੱਥੇ ਉਹ ਰੱਖ ਕੇ ਜਿਹੜਾ ਵਾ ਆਪਣਾ ਖਾਣਾ ਆਰਾਮ ਨਾਲ ਖਾ ਸਕਦੇ ਆ ਅਤੇ ਉਹ ਟ੍ਰੇਨ ਦੀ ਹਿਲਜੁਲ ਨਾਲ ਕੁਝ ਵੀ ਉੱਥੇ ਜਿਹੜਾ ਵਾ ਮਹਿਸੂਸ ਨਹੀਂ ਹੁੰਦਾ ਇਸ ਤੋਂ ਇਲਾਵਾ ਜੇ ਜਨਰਲ ਦੀ ਗੱਲ ਕਰੀਏ ਤਾਂ ਉੱਥੇ ਕੀ ਸੀਗਾ ਕਿ ਕੋਈ ਵੀ ਬੰਦਾ ਜਿਹਦੇ ਨਾਲ ਮਰਜ਼ੀ ਆ ਕੇ ਬੈਠ ਸਕਦਾ ਸੀਗਾ ਕੋਈ ਇਸ ਤਰ੍ਹਾਂ ਨਹੀਂ ਹੈਗਾ ਸੀ ਕੋਈ ਨੀਚੇ ਬੈਠ ਜਾਂਦੇ ਸੀਗੇ ਭੀੜ ਭਾੜ ਸੀਗੀ ਕਾਫੀ ਜ਼ਿਆਦਾ ਅਤੇ ਕੋਈ ਬੰਦਾ ਆਰਾਮ ਨਾਲ ਖਾ ਪੀ ਨਹੀਂ ਸੀ ਸਕਦਾ ਇਸ ਤੋਂ ਇਲਾਵਾ ਜਿਹੜਾ ਉਹਦਾ ਟ੍ਰੇਨ ਦਾ ਇੰਜਨ ਜੋ ਆਵਾਜ਼ ਬਹੁਤ ਹੁੰਦੀ ਟ੍ਰੇਨ ਦੀ ਆਪਾਂ ਕੋਈ ਮਤਲਬ ਇੰਨਾ ਜ਼ਿਆਦਾ ਸ਼ੋਰ ਹੁੰਦਾ ਜਦੋਂ ਤੇਜ਼ ਚੱਲਦੀ ਤਾਂ ਇੱਕਦਮ ਆਵਾਜ਼ ਆਉਂਦੀ ਆ ਬਹੁਤ ਜ਼ਿਆਦਾ ਰੌਲਾ ਰੱਪਾ ਹੁੰਦਾ ਹੈ ਉੱਥੇ ਉਹਦੇ ਜਿਹੜੇ ਪਹੀਏ ਵਾ ਉਹ ਵੀ ਜਿਹੜੇ ਆ ਬਹੁਤ ਆਵਾਜ਼ ਕਰਦੇ ਆ ਉਹਨਾਂ ਦੀ ਜਿਹੜੀ ਚੱਲਣ ਦੀ ਆਵਾਜ਼ ਜਿਹੜੀ ਆ ਉਹ ਬੈਠਿਆ ਅੰਦਰ ਮਹਿਸੂਸ ਹੁੰਦੀ ਆ ਉਹਦੇ ਵਿੱਚ ਬਸ ਇੱਦਾਂ ਹੈ ਕਿ ਆਪਾਂ ਨੂੰ ਇੱਕ ਆਰਾਮ ਨਾਲ ਸੀਟ ਮਿਲ ਜਾਂਦੀ ਆ ਬਾਕੀ ਜਿੰਨਾ ਸ਼ੋਰ ਹੋ ਜਾਵੇ ਇੰਜਨ ਦਾ ਸ਼ੋਰ ਹੋ ਜਾਵੇ ਜਾਂ ਧੂੰਆਂ ਵਗੈਰਾ ਵਾ ਉਹ ਸਭ ਜਿਹੜਾ ਵਾ ਉਦਾਂ ਹੀ ਆਪਾਂ ਨੂੰ ਮਹਿਸੂਸ ਹੁੰਦਾ ਜਾਂ ਆਵਾਜ਼ ਦੀ ਜੇ ਹੈਗੀ ਆ ਸੁਣਦੀ ਆ ਉਸ ਤੋਂ ਇਲਾਵਾ ਜਿਹੜਾ ਉਹਦਾ ਟਰੈਕ ਵਾ ਉਹ ਕਾਫੀ ਗੰਦਾ ਹੁੰਦਾ ਹੈ ਕਚਰਾ ਵਗੈਰਾ ਕਾਫੀ ਸੁੱਟਿਆ ਹੁੰਦਾ ਲੋਕਾਂ ਨੇ ਨੀਚੇ ਅਗਰ ਆਪਾਂ ਬੈ ਬਾਰੀ 'ਤੇ ਬੈਠੇ ਜੇ ਬਾਹਰ ਦੇਖੀਏ ਤਾਂ ਕੋਈ ਵੀ ਜਿਹੜਾ ਵਾ ਮਾਹੌਲ ਜਿਹੜਾ ਵਧੀਆ ਨਹੀਂ ਲੱਗਦਾ ਕਿੰਨਾ ਕਚਰਾ ਹੁੰਦਾ ਹੈ ਕਿੰਨਾ ਖਲਾਰਾ ਹੁੰਦਾ ਹੈ ਅਤੇ ਕੁਝ ਖ਼ਾਸ ਇੰਨਾ ਵਧੀਆ ਨਹੀਂ ਲੱਗਦਾ ਪਰ ਅਗਰ ਆਪਾਂ ਵਧੀਆ ਰੇਲ ਗੱਡੀ ਮਤਲਬ ਵਧੀਆ ਬੁੱਕ ਕਰਵਾਈਏ ਤਾਂ ਫਿਰ ਇਹ ਜਿਹੜੀਆਂ ਚੀਜ਼ਾਂ ਇਗਨੋਰ ਵੀ ਕੀਤੀਆਂ ਜਾ ਸਕਦੀਆਂ ਇਡੀਆਂ ਨਜ਼ਰ ਅੰਦਾਜ਼ ਆਪਾਂ ਕਰ ਸਕਦੇ ਹਾਂ ਆਰਾਮ ਨਾਲ ਹੀ ਇਸ ਤੋਂ ਇਲਾਵਾ ਰੇਲ ਗੱਡੀ ਦੇ ਅੰਦਰ ਜਿਹੜੇ ਬਾਥਰੂਮ ਹੁੰਦੇ ਆ ਉਹ ਬਿਲਕੁਲ ਵੀ ਵਧੀਆ ਨਹੀਂ ਹੁੰਦੇ ਕੋਈ ਸਾਫ਼ ਸਫਾਈ ਨਹੀਂ ਹੁੰਦੀ ਕੋਈ ਵੀ ਬੰਦਾ ਜਿਹੜਾ ਉਹਦੇ ਵਿੱਚ ਜਾ ਨਹੀਂ ਸਕਦਾ ਕਿ ਉਹ ਇੰਨੇ ਗੰਦੇ ਹੁੰਦੇ ਆ ਮੈਂ ਰੇਲ ਗੱਡੀ 'ਤੇ ਦੋ ਤਿੰਨ ਵਾਰ ਚੰਡੀਗੜ੍ਹ ਹੀ ਗਈ ਸੀਗੀ ਅਤੇ ਮੈਨੂੰ ਕੁਝ ਇਸ ਤਰ੍ਹਾਂ ਦਾ ਹੀ ਐਕਸਪੀਰੀਅੰਸ ਹੋਇਆ ਉੱਥੇ ਜਾ ਕੇ